ਮੈਂ ਔਨਲਾਈਨ ਐਪ ਤੋਂ ਮਸ਼ਹੂਰ ਬਰੈਂਡ ਦੀਆਂ ਬੈਡਸ਼ੀਟਸ ਮੰਗਵਾਈਆਂ ਸਨ ਉਹਨਾਂ ਦੇ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਹੈ ਅਤੇ ਕੱਪੜੇ ਦਾ ਰੰਗ ਵੀ ਨਹੀਂ ਨਿਕਲਿਆ ਡਿਜ਼ਾਇਨ ਵੀ ਬਹੁਤ ਵਧੀਆ ਹਨ ਮੈਂ ਅੱਗੇ ਤੋਂ ਵੀ ਇਸ ਬਰਾਂਡ ਦੀਆਂ ਬੈਡਸ਼ੀਟਸ ਮੰਗਾਉਣ ਲਈ ਸੋਚਾਂਗੀ